ਹੈਲੋ ਓਲਾ ਕੈਬ ਤੋਂ ਗੱਲ ਕਰ ਰਹੇ ਓਂ ਜੀ ਤੁਹਾਡੀ ਕੈਬ ਚਾਹੀਦੀ ਸੀ ਮੇਰੇ ਮੰਮੀ ਘਰ ਨਹੀਂ ਹਨ ਉਹ ਬ ਤਲਵੰਡੀ ਸਾਬੋ ਗਏ ਹੋਏ ਹਨ ਪਰ ਅਚਾਨਕ ਮੇਰੇ ਵੱਡੇ ਭਰਾ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਹਨਾਂ ਨੂੰ ਘਬ ਘਰ ਆਉਣਾ ਪਵੇਗਾ ਮੇਰਾ ਛੋਟਾ ਭਰਾ ਵੀ ਉਹਨਾਂ ਦੇ ਨਾਲ ਹੈ ਇਸ ਕਰਕੇ ਉਹ ਤਲਵੰਡੀ ਤੋਂ ਘੁਦੇ ਪਹੁੰਚਣਾ ਚਾਹੁੰਦੇ ਹਨ ਰਸਤਾ ਤਲਵੰਡੀ ਤੋਂ ਵਾਇਆ ਬਠਿੰਡੇ ਹੋ ਕੇ ਜੈ ਸਿੰਘ ਤੋਂ ਨਰਵਾਣਾ ਹੋ ਕੇ ਉਹਨਾਂ ਨੂੰ ਘੁੱਦੇ ਪਹੁੰਚਾ ਸਕਦੇ ਹੋ ਅਤੇ ਇਸਦੀ ਕੈਬ ਦੀ ਕੀਮਤ ਕਿੰਨੀ ਹੋਵੇਗੀ